ਨਮਸਕਾਰ ਜੀ ਮੈਂ ਸੁਨੀਤਾ ਰਾਣੀ ਬੋਲ ਰਹੀ ਹਾਂ ਇੱਕ ਮਹੀਨਾ ਪਹਿਲਾਂ ਮੈਂ ਆਪ ਜੀ ਦੇ ਵਿਭਾਗ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਦਾ ਨੰਬਰ ਪੰਜ ਸੱਤ ਚਾਰ ਤਿੰਨ ਦੋ ਇੱਕ ਛੇ ਹੈ ਮੈਂ ਉਸ ਦੀ ਮੌਜੂਦਾ ਸਥਿਤੀ ਨੂੰ ਜਾਨਣਾ ਚਾਹੁੰਦੀ ਹਾਂ ਕਿ ਇਸ ਸਮੱਸਿਆ ਦਾ ਹੱਲ ਹੋਇਆ ਹੈ ਕਿ ਨਹੀਂ ਜੇਕਰ ਨਹੀਂ ਹੋਇਆ ਤਾਂ ਇਸ ਨੂੰ ਜਲਦੀ ਤੋਂ ਜਲਦੀ ਹਲ ਕੀਤਾ ਜਾਵੇ